ਹੁਣ ਦਸ ਕੁ ਦਿਨ ਪਹਿਲਾਂ ਇੱਕ ਬਿਲਕੁਲ ਵਧੀਆ ਜਿ ਜਿਹਨੂੰ ਅਸੀਂ ਕਹਿੰਦੇ ਹਾਂ ਖਬਰ ਆਈ ਸੀ ਕਿ ਪੰਜ ਬੰਦੇ ਜਿਹੜੇ ਅਰਬਪਤੀ ਟਾਈਟੈਨਿਕ ਜਿਹੜਾ ਅੱਜ ਤੋਂ ਵੀਹ ਪੱਚੀ ਤੀਹ ਸਾਲ ਪਹਿਲਾਂ ਡੁੱਬ ਗਿਆ ਸੀ ਉਹਨੂੰ ਦੇਖਣ ਵਾਸਤੇ ਗਏ ਪਰ ਡੁੱਬ ਹੀ ਗਿਆ ਕੀ ਸੀ ਉਹ ਕਿ ਅਸੀਂ ਆਪਣਾ ਜਿਹੜਾ ਪਿਛੋਕੜ ਹੈ ਸੱਭਿਆਚਾਰ ਹੈ ਜਾਂ ਜਿਹੜਾ ਸਾਡਾ ਕੁਦਰਤ ਹੈ ਉਹਦੇ ਨਾਲ ਅਸੀਂ ਖਿਲਵਾੜ ਕਰ ਰਹੇ ਹਾਂ ਅਸੀਂ ਇਹ ਸੋਚਦੇ ਹਾਂ ਕਿ ਅਸੀਂ ਨਵਾਂ ਬ੍ਰਹਿਮੰਡ ਜਾਂ ਨਵਾਂ ਇੱਕ ਸੰਸਾਰ ਬਣਾ ਸਕਦੇ ਹਾਂ ਨਹੀਂ ਇਹ ਨਹੀਂ ਹੋ ਸਕਦਾ ਅਸੀਂ ਜਦੋਂ ਜਦੋਂ ਵੀ ਕੁਦਰਤ ਨਾਲ ਖਿਲਵਾੜ ਕੀਤਾ ਅਸੀਂ ਉਹਦੇ ਵਿੱਚ ਖਤਾ ਖਾਧੀ ਅਸੀਂ ਕਹਿੰਦੇ ਹਾਂ ਕਿ ਸਾਡੇ ਨਾਲ ਹੋਰ ਵੀ ਦੂਜਾ ਵੀ ਬ੍ਰਹਿਮੰਡ ਐ ਕੋਈ ਹੋਰ ਗ੍ਰਹਿ ਹੋ ਸਕਦਾ ਜਿਹਨੂੰ ਅਸੀਂ ਇੰਗ ਅੰਗਰੇਜ਼ੀ 'ਚ ਕਹਿੰਦੇ ਹਾਂ ਕਿ ਸਾਡੇ ਹੋਰ ਦੂਜੇ ਗ੍ਰਹਿ ਤੋਂ ਪ੍ਰਾਣੀ ਸਾਡੀ ਧਰਤੀ 'ਤੇ ਆਉਂਦੇ ਹੈ ਕੀ ਕਿਸੇ ਨੇ ਦੇਖੇ ਅਗਰ ਦੇਖੇ ਵੀ ਹੈ ਕੀ ਉਹਦਾ ਕੋਈ ਪ੍ਰਮਾਣ ਹੈ ਨਹੀਂ ਇਹਦੇ ਨਾਲ ਮੈਂ ਸਹਿਮਤ ਨਹੀਂ ਹਾਂ ਅਸੀਂ ਬਹੁਤ ਜ਼ਿਆਦਾ ਆਪਣੇ ਆਪ ਨੂੰ ਇਸ ਤਰ੍ਹਾਂ ਸੋਚਦੇ ਹਾਂ ਕਿ ਅਸੀਂ ਪੈਸੇ ਦੇ ਨਾਲ ਕੁਝ ਵੀ ਕਰ ਸਕਦੇ ਹਾਂ ਲੇਕਿਨ ਇਹ ਮੁਮਕਿਨ ਨਹੀਂ ਹੈ